ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਆਪਣੀ ਕੁਝ ਮਨਪਸੰਦ ਬਾਈਕਾਂ ਬਾਰੇ ਦੱਸਣਾ ਚਾਹੁੰਦਾ ਹਾਂ ਵੈਸੇ ਤਾਂ ਦੁਨੀਆ ਵਿੱਚ ਬਹੁਤ ਸਾਰੀ ਬਾਈਕਾਂ ਹਨ ਪਰ ਮੇਰੀ ਮਨਪਸੰਦ ਬਾਈਕ ਰੋਇਲ ਇਨਫੀਲਡ ਬੁਲੇਟ ਹੀਰੋ ਸਪਲੈਂਡਰ ਅਤੇ ਹਾਰਲੇ ਹੈ ਇਹ ਬਾਈਕਾਂ ਮੈਨੂੰ ਬਹੁਤ ਪਸੰਦ ਹਨ ਮੈਂ ਇਹਨਾਂ ਵਿੱਚੋਂ ਰੋਇਲ ਇਨਫੀਲਡ ਬੁਲੇਟ ਅਤੇ ਹੀਰੋ ਸਪਲੈਂਡਰ ਦਾ ਮਾਲਿਕ ਹਾਂ ਬਾਈਕਿੰਗ ਯਾਤਰਾਵਾਂ ਲਈ ਬਹੁਤ ਸਾਰੀ ਬਾਈਕਾਂ ਹਨ ਪਰ ਆਰਾਮਦਾਇਕ ਬਾਈਕਾਂ ਹਨ ਬੁਲੇਟ ਅਤੇ ਕਾਓਸਾਕੀ ਦੀਆਂ ਉੱਚ ਸ਼੍ਰੇਣੀ ਦੀਆਂ ਬਾਈਕਾਂ ਜਿਨ੍ਹਾਂ ਜੋ ਕਿ ਵੱਡੇ ਸਾਈਜ਼ ਕਰਕੇ ਆਰਾਮਦਾਇਕ ਹੁੰਦੀਆਂ ਹਨ ਅਤੇ ਇਹਨਾਂ ਦੀ ਸੀਟ ਵੀ ਬਹੁਤ ਕੰਫਰਟੇਬਲ ਹੁੰਦੀ ਹੈ ਧੰਨਵਾਦ